ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਹੈ ਮੈਂ ਪਠਾਨਕੋਟ ਤੋਂ ਬੋਲਦੀ ਪਈ ਹਾਂ ਜਿੱਦਾਂ ਕਿ ਮੈਂ ਤੁਹਾਡੇ ਢਾਬੇ ਤੋਂ ਕੁਛ ਚੀਜ਼ਾਂ ਔਡਰ ਕਰਨਾ ਚਾਹੁੰਦੀ ਹਾਂ ਮੇਰੇ ਬੇਟੇ ਦਾ ਜਨਮਦਿਨ ਹੈ ਜਿੱਦਾਂ ਕਿ ਬਰਗਰ ਪੀਜ਼ਾ ਮੋਮੋਜ ਨਿਊਡਲਸ ਔਰ ਰੋਟੀ ਵਿੱਚ ਦਾਲ ਫੁਲਕਾ ਚੌਲ ਰਾਜਮਾ ਮਟਰ ਪਨੀਰ ਮੇਰੇ ਬੇਟੇ ਨੂੰ ਪਨੀਰ ਪਸੰਦ ਹੈ ਮੈਂ ਪਨੀਰ ਦੀ ਸਬਜ਼ੀ ਔਰ ਕੇਕ ਔਡਰ ਕਰਨਾ ਚਾਹੁੰਦੀ ਹਾਂ ਸਰ ਉਸ ਵਿੱਚ ਕੋਈ ਮੇਰੇ ਘਰਦਿਆਂ ਨੂੰ ਮਸਾਲੇ ਹ ਹਲਕੇ ਪਸੰਦ ਹੈ ਇਸ ਕਰਕੇ ਥੋੜ੍ਹੇ ਮਸਾਲੇ ਘੱਟ ਤੋਂ ਘੱਟ ਅਤੇ ਜੀ ਸਬਜ਼ੀ ਵਾਲੇ ਕਿ ਘੱਟ ਤੋਂ ਘੱਟ ਸਬਜ਼ੀ ਵਿੱਚ ਪਾ ਕੇ ਭੇਜੇ ਜਾਣ ਇਸ ਕਰਕੇ ਜਦੋਂ ਤੁਸੀਂ ਮੇਰੇ ਘਰ ਆਓ ਤਾਂ ਮੈਂ ਤੁਹਾਡਾ ਬਿੱਲ ਪੇਅ ਕਰ ਦੇਵਾਂਗੀ